ਸਾਡੇ ਖੇਤਰ ਦੇ ਗੁਰਦੁਆਰੇ ਵਿੱਚ ਬੱਚਿਆਂ ਦੀ ਧਾਰਮਿਕ ਰੁਚੀ ਵਧਾਉਣ ਦੇ ਲਈ ਅਲੱਗ ਅਲੱਗ ਉਪਰਾਲੇ ਸਮੇਂ ਸਮੇਂ 'ਤੇ ਕੀਤੇ ਜਾਂਦੇ ਹਨ ਜਿਵੇਂ ਕਿ ਹਰਮੋਨੀਅਮ ਸਿਖਾਇਆ ਜਾਂਦਾ ਹੈ ਉਹਨਾਂ ਨੂੰ ਤਬਲਾ ਜਿਹੜਾ ਹੈ ਉਹ ਵਜਾਉਣਾ ਸਿਖਾਇਆ ਜਾਂਦਾ ਹੈ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਹੋਰ ਵੀ ਕਈ ਮੁਕਾਬਲੇ ਜਿਹੜੇ ਆ ਉਹ ਬੱਚਿਆਂ ਦੇ ਵਿੱਚ ਕਰਵਾਏ ਜਾਂਦੇ ਹਨ ਫਿਰ ਉਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਉੱਤੇ ਮੁਕਾਬਲਿਆਂ ਦੇ ਵਿੱਚ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਇਨਾਮ ਵਜੋਂ ਕੁਛ ਰਾਸ਼ੀ ਦਿੱਤੀ ਜਾਂਦੀ ਹੈ ਅਤੇ ਕਈਆਂ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ ਫਿਰ ਜਿਹੜੇ ਬੱਚੇ ਹਰਮੋਨੀਅਮ ਤਬਲਾ ਸਿੱਖ ਲੈਂਦੇ ਨੇ ਉਹ ਕਈ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੱਕ ਦੇ ਕੌਂਪੀਟੀਸ਼ਨ ਦੇ ਵਿੱਚ ਜਾ ਕੇ ਸਾਡੇ ਦੇਸ਼ ਦਾ ਸਾਡੇ ਸ਼ਹਿਰ ਦਾ ਨਾਮ ਜਿਹੜਾ ਹੈ ਉਹ ਉੱਚਾ ਕਰਦੇ ਨੇ ਅਤੇ ਇਹਨਾਂ ਚੀਜ਼ਾਂ ਨੂੰ ਹੀ ਮਤਲਬ ਹਰਮੋਨੀਅਮ ਤਬਲੇ ਨੂੰ ਕਹਿ ਲਓ ਜਾਂ ਕੀਰਤਨ ਕਰਨ ਨੂੰ ਹੀ ਉਹਨਾਂ ਨੇ ਆਪਣੇ ਰੁਜ਼ਗਾਰ ਵਜੋਂ ਜਿਹੜਾ ਹੈ ਉਹ ਅਪਣਾਇਆ ਜਿਵੇਂ ਸਾਡੇ ਇਲਾਕੇ ਦੇ ਲਾਗੇ ਬੰਨੇ ਕਿਸੇ ਦੇ ਘਰ ਵੀ ਅਗਰ ਕਿਸੇ ਨੇ ਕੀਰਤਨ ਕਰਵਾਉਣਾ ਹੋਵੇ ਤਾਂ ਉਹਨਾਂ ਬੱਚਿਆਂ ਨੂੰ ਸੱਦਦੇ ਨੇ ਅਤੇ ਫਿਰ ਉਹਨਾਂ ਨੂੰ ਪੈਸੇ ਦੀ ਜਿਹੜੀ ਕਮਾਈ ਹੈ ਕਹਿ ਲਓ ਉਹ ਵੀ ਹਰਮੋਨੀਅਮ ਤਬਲੇ ਤੋਂ ਜਾਂ ਕਹਿ ਲਓ ਕੀਰਤਨ ਕਰਨ ਦੇ ਨਾਲ ਹੁੰਦੀ ਹੈ ਫਿਰ ਰੋਜ਼ ਸ਼ਾਮ ਨੂੰ ਜਿਹੜੇ ਇਹ ਸਾਡੇ ਪਿੰਡ ਦੇ ਗੁਰਦੁਆਰੇ ਦੇ ਵਿੱਚ ਬੱਚੇ ਆ ਕੇ ਪਾਠ ਕਰਦੇ ਨੇ ਉਹਨਾਂ ਨੂੰ ਕਈ ਬਾਣੀਆਂ ਦਾ ਪਾਠ ਜਿਹੜਾ ਹੈ ਉਹ ਜੁਬਾਨੀ ਹੀ ਕੰਠ ਹੈ ਉਹ ਸਿਰਫ਼ ਇਸੇ ਕਰਕੇ ਕਿ ਸਮੇਂ ਸਮੇਂ 'ਤੇ ਸਾਡੇ ਪਿੰਡ ਦੇ ਗੁਰਦੁਆਰੇ ਵਿੱਚ ਗੁਰਬਾਣੀ ਕੰਠ ਮੁਕਾਬਲੇ ਜਿਹੜੇ ਨੇ ਉਹ ਕਰਵਾਏ ਜਾਂਦੇ ਹਨ ਬੱਚਿਆਂ ਦੇ ਮਾਪੇ ਵੀ ਇਸ ਚੀਜ਼ ਦਾ ਬੜਾ ਉਤਸ਼ਾਹ ਦੇ ਨਾਲ ਕਹਿ ਲਓ ਇਸ ਚੀਜ਼ ਦੀ ਸ਼ਲਾਘਾ ਕਰਦੇ ਨੇ ਕਿ ਸਾਡੇ ਇਲਾਕੇ ਦੇ ਵਿੱਚ ਅਜਿਹੀਆਂ ਚੀਜ਼ਾਂ ਨੂੰ ਵੀ ਬੜਾਵਾ ਦਿੱਤਾ ਜਾ ਰਿਹਾ